ਹੈਲੋ ਹਾਂਜੀ ਸਰ ਦੇਖਣ ਵਿੱਚ ਆ ਰਿਹਾ ਹੈ ਕਿ ਜੋ ਡਰਾਈਵਰ ਨੇ ਜਿਵੇਂ ਕਿ ਕੋਵਿਡ ਚੱਲ ਰਿਹਾ ਹੈਗਾ ਹੈ ਨਾ ਉਹਦੇ ਵਿੱਚ ਉਹਨਾਂ ਨੇ ਮਾਸਕ ਨਹੀਂ ਪਾਇਆ ਹੋਇਆ ਮੈਂ ਸਫਰ ਕਰ ਰਹੀ ਸੀ ਮੈਂ ਦੇਖਿਆ ਡਰਾਈਵਰ ਨੇ ਮਾਸਕ ਨਹੀਂ ਪਾਇਆ ਹੋਇਆ ਸੀ ਬਸ ਦੇ ਵਿੱਚ ਬਿਲਕੁਲ ਸਫਾਈ ਨਹੀਂ ਸੀ ਨਹੀਂ ਸੀ ਠੀਕ ਹੈ ਬਹੁਤ ਬੁਰਾ ਹਾਲ ਸੀ ਜਿਵੇਂ ਕਿ ਬਹੁਤ ਜ਼ਿਆਦਾ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਸਾਰਿਆਂ ਲਈ ਮਾਸਕ ਜ਼ਰੂਰੀ ਹੈ ਪਰ ਜਿਵੇਂ ਡਰਾਈਵਰ ਹੀ ਮਾਸਕ ਨਹੀਂ ਪਾਉਗਾ ਤਾਂ ਬਾਕੀ ਪਬਲਿਕ ਕਿਵੇਂ ਪਾਊਗੀ ਆਮ ਲੋਕਾਂ ਲਈ ਤਾਂ ਨਹੀਂ ਹੈ ਕਿਉਂਕਿ ਡਰਾਈਵਰ ਦਾ ਸਾਹਮਣਾ ਬਹੁਤ ਜ਼ਿਆਦਾ ਲੋਕਾਂ ਨਾਲ ਹੁੰਦਾ ਇਸੇ ਲਈ ਸਰ ਵੀ ਇਹ ਤੁਹਾਨੂੰ ਹਦਾਇਤ ਕਰਨਾ ਚਾਹੁੰਦੀ ਹਾਂ ਕਿ ਤੁਹਾਡੇ ਵੱਲੋਂ ਇਹ ਸਖਤ ਹੁਕਮ ਹੋਣੇ ਚਾਹੀਦੇ ਨੇ ਕਿ ਡਰਾਈਵਰਾਂ ਲਈ ਤਾਂ ਆਪਣੇ ਜਿੰਨੇ ਵੀ ਕੰਮ ਕਰਨ ਵਾਲੇ ਮੁਲਾਜ਼ਮ ਨੇ ਉਹਨਾਂ ਲਈ ਮਾਸਕ ਜ਼ਰੂਰੀ ਹੋਣਾ ਚਾਹੀਦਾ ਅਤੇ ਆਪਣੇ ਜੋ ਵੀ ਆਪਣਾ ਸਾਧਨ ਹੈ ਉਹਨਾਂ ਕੋਲ ਬਸ ਹੈ ਕੁਛ ਵੀ ਹੈ ਉਹਦੇ ਵਿੱਚ ਪ੍ਰੋਪਰ ਚੰਗੀ ਤਰ੍ਹਾਂ ਸਫਾਈ ਹੋਣੀ ਚਾਹੀਦੀ ਹੈ ਜੇ ਡਰਾਈਵਰ ਮਾਸਕ ਪਹਿਨਣਗੇ ਆਪਾਂ ਅ ਆਪਣੇ ਜੋ ਕੰਮ ਕਰਨ ਵਾਲੇ ਨੇ ਆਪਣੇ ਮੁਲਾਜ਼ਮ ਨੇ ਉਹ ਮਾਸਕ ਪਹਿਨਣਗੇ ਤਾਂ ਆਮ ਜਨਤਾ ਨੂੰ ਹੀ ਉਹਨਾਂ ਤੋਂ ਸਿੱਖਿਆ ਮਿਲੂਗੀ ਨਹੀਂ ਤਾਂ ਇਹ ਇਸ ਬਿਮਾਰੀ ਨੂੰ ਆਪਾਂ ਕਿਵੇਂ ਕੰਟਰੋਲ ਵਿੱਚ ਕਰ ਸਕਾਂਗੇ ਜੇ ਆਪਾਂ ਹੀ ਜੋ ਆਪਾਂ ਅੱਗੇ ਲੱਗੇ ਹੋਏ ਆ ਮੁਲਾਜ਼ਮ ਲੋਕ ਜੋ ਆਪਾਂ ਸੇਧ ਦੇਣ ਵਾਲੇ ਹਾਂ ਲੋਕਾਂ ਨੂੰ ਆਪਾਂ ਸਿਖਾਉਣ ਵਾਲੇ ਹਾਂ ਆਪਾਂ ਨਹੀਂ ਆਪਾਂ ਉਹ ਕਰ ਸਕਦੇ ਤਾਂ ਫਿਰ ਦੂਸਰੇ ਆਪਣੇ ਤੋਂ ਕੀ ਸਿੱਖ ਸਕਦੇ ਹਨ ਇਸ ਲਈ ਸਰ ਤੁਹਾਡੇ ਅੱਗੇ ਮੇਰੀ ਇਹੀ ਬੇਨਤੀ ਹੈ ਤੁਹਾਨੂੰ ਹਦਾਇਤ ਹੈ ਕਿ ਡਰਾਈਵਰ ਜੋ ਵੀ ਡਰਾਈਵਰ ਨੇ ਉਹ ਉਹਨਾਂ ਨੂੰ ਸਭ ਤੋਂ ਪਹਿਲਾਂ ਇਸ ਗੱਲ ਲਈ ਸਖਤਾਈ ਕੀਤੀ ਜਾਵੇ ਕਿ ਕੋਵਿਡ ਚੱਲ ਰਿਹਾ ਹੈ ਇਸ ਵਿੱਚ ਡਰਾਈਵਰ ਲਈ ਮਾਸਕ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਆਪਣੇ ਆਲੇ ਦੁਆਲੇ ਦੀ ਸਫਾਈ ਆਪਣੀ ਗੱਡੀ ਦੀ ਸਫਾਈ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਹਾਂਜੀ ਸਰ ਬਸ ਮੈਂ ਤੁਹਾਨੂੰ ਇਹੀ ਗੱਲ ਧਿਆਨ ਦਿਵਾਉਣਾ ਚਾਹੁੰਦੀ ਸੀ ਕਿਉਂਕਿ ਮੈਂ ਸਫਰ ਕਰ ਰਹੀ ਸੀ ਸਫਰ ਦੇ ਵਿੱਚ ਮੈਂ ਦੇਖਿਆ ਜੋ ਡਰਾਈਵਰ ਸੀ ਉਸਨੇ ਪੂਰੇ ਰਸਤੇ ਵਿੱਚ ਕੋਈ ਮਾਸਕ ਨਹੀਂ ਪਾਇਆ ਹੋਇਆ ਸੀ ਐਵੇਂ ਹੀ ਉਹ ਲੋਕਾਂ ਲੋਕ ਉਸਦੇ ਨੇੜੇ ਆ ਰਹੇ ਸੀ ਲੋਕਾਂ ਦੇ ਸੰਪਰਕ ਵਿੱਚ ਆ ਰਿਹਾ ਸੀ ਪਰ ਇਹ ਮੈਨੂੰ ਸਹੀ ਨਹੀਂ ਲੱਗਿਆ ਇਹ ਮੈਂ ਤੁਹਾਡੇ ਧਿਆਨ ਵਿੱਚ ਦਵਾਉਣਾ ਚਾਹੁੰਦੀ ਹਾਂ ਸਰ ਹਾਂਜੀ ਸਰ ਓਕੇ ਧੰਨਵਾਦ ਜੀ